ਸਭ ਤੋਂ ਮਸ਼ਹੂਰ ਭੰਗੜੇ ਦੇ ਗੀਤ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਚੱਲਗੇ ਨੇ ਅਤੇ ਉਨ੍ਹਾਂ ਦੇ ਸਿੰਗਰ ਵੀ ਬਹੁਤ ਜ਼ਿਆਦਾ ਹਨ ਓਨਾਂ ਜਿੰਨਾ ਨੇ ਨਵਾਂ ਹੀ ਗੀ ਇਹਨਾਂ ਨੂੰ ਰੂਪ ਦੇ ਤਾਂ ਭੰਗੜੇ ਦੇ ਗੀਤਾਂ ਨੂੰ ਜਿੰਨੇ ਵਿੱਚੋਂ ਸਾਡੇ ਵਰਗੀ ਉਮਰ ਦੇ ਲੋਕਾਂ ਨੂੰ ਤਾਂ ਕਾਫ਼ੀ ਕੁਛ ਸਮਝ ਵੀ ਨਹੀਂ ਆਉਂਦਾ ਸਾਡੇ ਪਹਿਲੇ ਸ਼ੁਰੂ ਦੇ ਭੰਗੜੇ ਦੇ ਵਿੱਚੋਂ ਇੱਕ ਗੀਤ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ਼ ਨੀ ਇਹ ਮੇਰੇ ਗੀਤ ਦਿਲ ਦੇ ਬਹੁਤ ਕਰੀਬ ਹੈ ਇਹ ਮੈਨੂੰ ਗਾਣਾ ਬਹੁਤ ਪਸੰਦ ਹੈ ਅਤੇ ਇਹਦੇ 'ਤੇ ਥੋੜ੍ਹਾ ਬਹੁਤਾ ਨ ਡਾਂਸ ਵੀ ਕਰ ਲੈਂਦੇ ਹਾਂ ਇਹ ਲੋਕਾਂ ਨ ਕਾਫ਼ੀ ਲੋਕਾਂ ਇਹ ਗਾਣਾ ਪੁਰਾਣਾ ਗਾਣਾ ਬਹੁਤ ਪਸੰਦ ਹੈ ਅਤੇ ਜਿਹੜੇ ਹੋਰ ਵੀ ਅੱਜ ਕੱਲ੍ਹ ਜਿਵੇਂ ਸਿੰਗਰ ਨੇ ਦਲਜੀਤ ਅਮਰਿੰਦਰ ਗਿੱਲ ਹੈ ਭੰਗੜੇ ਦੇ ਕਾਫ਼ੀ ਗੀਤ ਸ਼ੁਰੂ ਕਰ ਦਿੱਤੇ ਨੇ ਅਤੇ ਮੇਰਾ ਮਨ ਮਨਪਸੰਦ ਗੀਤ ਵਿੱਚੋਂ ਐਹ ਵੀ ਬੋਲਦੇ ਰਹਿੰਦੇ ਨੇ ਹੋਰ ਸਾਰੇ ਸਾਡੇ ਸ ਆਸੇ ਪਾਸੇ ਵੀ ਭੰਗੜੇ ਦੇ ਬਹੁਤ ਜ਼ਿਆਦਾ ਗੀਤ ਹਨ ਜਿਹੜੇ ਸਾਨੂੰ ਤਾਂ ਅਜੇ ਤੱਕ ਪਤਾ ਵੀ ਨਹੀਂ ਚੱਲਾ ਕਿ ਕਿਸ ਤਰ੍ਹਾਂ ਬੋਲਦੇ ਨੇ ਸਭ ਤੋਂ ਮਸ਼ਹੂਰ ਭੰਗੜੇ ਦਾ ਗੀਤ ਓਹੀ ਹੈ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ਼ ਨੀ ਇਹ ਮੈਨੂੰ ਬਹੁਤ ਪਸੰਦ ਹੈ ਅਸੀਂ ਸ਼ੁਰੂ ਤੋਂ ਛੋਟੇ ਹੁੰਦਿਆਂ ਤੋਂ ਇਹ ਗਾਣਾ ਸੁਣਦੇ ਆ ਰਹੇ ਹਾਂ ਜਿਹੜਾ ਬਹੁਤ ਵਧੀਆ ਹੈ ਹੋਰ ਸਾਡੇ ਸੱਭਿਆਚਾਰ ਵਿੱਚ ਭੰਗੜੇ ਨੂੰ ਬਹੁਤ ਮਸ਼ੁ ਭੰਗੜੇ ਦੇ ਬਹੁਤ ਜ਼ਿਆਦਾ ਡਾਂਸ ਵਗੈਰਾ ਹੁੰਦੇ ਨੇ ਧੰਨਵਾਦ